ਹੈਲੋ ਹਾਂਜੀ ਐਮਾਜੋਨ ਤੋਂ ਗੱਲ ਕਰ ਰਹੇ ਜੀ ਹਾਂਜੀ ਮੈਂ ਨਾ ਐਕਚੁਲੀ ਤੁਹਾਡੇ ਤੋਂ ਪਹਿਲਾਂ ਕੁਛ ਇੱਕ ਏਅਰ ਬਲੋਰ ਖਰੀਦਿਆ ਸੀ ਅਤੇ ਮੈਂ ਉਹਦੇ ਬਾਰੇ ਤੁਹਾਨੂੰ ਕੁਛ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਇਹ ਜਿਹੜਾ ਏਲ ਏਅਰ ਬਲੋਰ ਹੈ ਇਹ ਬਹੁਤ ਵਧੀਆ ਚੀਜ਼ ਆ ਅਤੇ ਜਦੋਂ ਮੈਂ ਪਹਿਲਾਂ ਭਾਲਦਾ ਰਿਹਾ ਕਿ ਲੱਭਦਾ ਰਿਹਾ ਇੱਥੇ ਅੰਮ੍ਰਿਤਸਰ ਸਾਨੂੰ ਨਹੀਂ ਮਿਲਿਆ ਅਤੇ ਫਿਰ ਮੈਂ ਤੁਹਾਡੀ ਸਾਈਟ 'ਤੇ ਜਾ ਕੇ ਜਦੋਂ ਵੇਖਿਆ ਤਾਂ ਮੈਨੂੰ ਉੱਥੋਂ ਮਿਲਿਆ ਅਤੇ ਫਿਰ ਮੈਂ ਔਡਰ ਕੀਤਾ ਅਤੇ ਜਦੋਂ ਮੈਂ ਇਹਦਾ ਪ੍ਰਾਈਸ ਦੇਖਿਆ ਇਹਦਾ ਅਤੇ ਇਹਦਾ ਪ੍ਰਾਈਸ ਵੀ ਬਹੁਤ ਜਾਇਜ਼ ਸੀ ਬਹੁਤ ਘੱਟ ਸੀ ਅਤੇ ਇਹ ਬਹੁਤ ਵਧੀਆ ਚੀਜ਼ ਹੈ ਅਤੇ ਤੁਸੀਂ ਮੈਨੂੰ ਜਦੋਂ ਇਹ ਮੈਂ ਤੁਹਾਨੂੰ ਆਡਰ ਕੀਤਾ ਇਹ ਮੈਨੂੰ ਪੰਜਵੇਂ ਦਿਨ ਆਉਣ ਕੇ ਅਤੇ ਮਿਲ ਗਿਆ ਬਹੁਤ ਜਲਦੀ ਮਿਲ ਗਿਆ ਮੈਂ ਤਾਂ ਇੰਨਾ ਸੋਚਿਆ ਨਹੀਂ ਸੀ ਵੀ ਇਹ ਇੰਨੀ ਜਲਦੀ ਮਿਲ ਜਾਊਗਾ ਅਤੇ ਤੁਹਾਡੀ ਸਰਵਿਸ ਜਿਹੜੀ ਉਹ ਬਹੁਤ ਵਧੀਆ ਵਾ ਅਤੇ ਇਹ ਜਿਹੜਾ ਬਣਿਆ ਵੀ ਬਹੁਤ ਸੋਹਣਾ ਹੈ ਜਦੋਂ ਵੀ ਅਸੀਂ ਆਪਣਾ ਘਰ ਸਾਫ਼ ਕਰਦੇ ਹਾਂ ਜਾਂ ਬਗੀਚਾ ਸਾਫ਼ ਕਰਦੇ ਹਾਂ ਤਾਂ ਇਹਦਾ ਹਵਾ ਦਾ ਪ੍ਰੈਸ਼ਰ ਇੰਨਾ ਕਿ ਇਹ ਪੱਤੇ ਪੁੱਤੇ ਸਾਰੇ ਲੈ ਜਾਂਦਾ ਉਡਾ ਕੇ ਅਤੇ ਜਿਹੜਾ ਦੋ ਘੰਟਿਆਂ ਦਾ ਕੰਮ ਆ ਉਹ ਦਸਾਂ ਮਿੰਟਾਂ 'ਚ ਮੁਕਾ ਕੇ ਅਤੇ ਅਸੀਂ ਵਿਹਲੇ ਹੋ ਜਾਂਦੇ ਹਾਂ ਅਤੇ ਇਹ ਬਹੁਤ ਵਧੀਆ ਚੀਜ਼ ਹੈ ਬਾਕੀ ਜਿਹੜਾ ਇਹਦਾ ਇਹਦੀ ਬੈਟਰੀ ਆ ਉਹ ਵੀ ਬਹੁਤ ਵਧੀਆ ਏ ਜਦੋਂ ਲਾਈਟ ਨਹੀਂ ਹੁੰਦੀ ਤਾਂ ਬੈਟਰੀ 'ਤੇ ਵੀ ਇਹ ਕੰਮ ਕਰਦਾ ਤਾਂ ਬਾਕੀ ਜਿਹੜੇ ਬਿਜਲੀ ਦੇ ਵਾਇਰਾਂ ਲੱਗੀਆਂ ਜੋ ਵੀ ਇਹਦਾ ਬਿਜਲੀ ਦਾ ਸਿਸਟਮ ਆ ਬਹੁਤ ਵਧੀਆ ਇਹਦਾ ਕੋਈ ਡਰ ਨਹੀਂ ਕਰੰਟ ਦਾ ਅਤੇ ਇਹ ਬੇ